ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਐੱਸ ਬੀ ਐੱਸ ਨਗਰ ਤੋਂ ਅੰਮ੍ਰਿਤ ਕੌਰ ਬੋਲ ਰਹੀ ਹਾਂ ਜੀ ਹਾਂਜੀ ਭਾਅ ਜੀ ਤੁਹਾਡੀ ਫਰੂਟਸ ਦੀ ਸ਼ੋਪ ਆ ਮੈਨੂੰ ਕੁਛ ਫਰੂਟਸ ਚਾਹੀਦੇ ਸੀਗੇ ਅ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਕਿਹੜੇ ਫਰੂਟਸ ਤੁਹਾਡੀ ਸ਼ੋਪ 'ਤੇ ਅਵੈਲੇਬਲ ਹੈਗੇ ਨੇ ਠੀਕ ਹੈ ਜੀ ਸਰ ਐਪਲ ਅ ਐਪਲ ਦਾ ਕੀ ਪ੍ਰਾਈਜ਼ ਆ ਅੱਛਾ ਜੀ ਜਿਹੜੇ ਕਸ਼ਮੀਰੀ ਐਪਲ ਆ ਉਹ ਫਰੈੱਸ਼ ਨੇ ਠੀਕ ਆ ਮੈਨੂੰ ਫਰੈੱਸ਼ ਹੀ ਚਾਹੀਦੇ ਆ ਅਤੇ ਗਵਾਵਾ ਕਿਸ ਤਰ੍ਹਾਂ ਹੈ ਠੀਕ ਹੈ ਔਰ ਪਪੀਤਾ ਹੈਗਾ ਤੁਹਾਡੇ ਕੋਲ ਠੀਕ ਆ ਔਰ ਭਾਅ ਜੀ ਉਹ ਬਿਲਕੁਲ ਦਾਗੀ ਨਹੀਂ ਹੋਣਾ ਚਾਹੀਦਾ ਮੈਨੂੰ ਪੀਲਾ ਵਾਲਾ ਚਾਹੀਦਾ ਠੀਕ ਆ ਉਹ ਪਪੀਤਾ ਕਿਸ ਤਰ੍ਹਾਂ ਹੈ ਉਹਦਾ ਕੀ ਰੇਟ ਆ ਅੱਛਾ ਜੀ ਠੀਕ ਆ ਮੈਨੂੰ ਦੋ ਕਿਲੋ ਚਾਹੀਦਾ ਹੈ ਹੋਰ ਕੀਵੀ ਹੈਗੀ ਤੁਹਾਡੇ ਕੋਲ ਅੱਛਾ ਕੀਵੀ ਕਿਸ ਤਰ੍ਹਾਂ ਹੈ ਪ ਪਰ ਪਰ ਪੀਸ ਕਿੱਦਾਂ ਹੈ ਠੀਕ ਹੈ ਮੈਨੂੰ ਛੇ ਪੀਸ ਦੇ ਦਿਓ ਛੇ ਪੀਸ ਦੇ ਦਿਓ ਹਾਂਜੀ ਠੀਕ ਹੈ ਹੋਰ ਬਨਾਨਾ ਹੈਗੇ ਨੇ ਹਾਂ ਉਹ ਕਿਸ ਤਰ੍ਹਾਂ ਦਰਜਨ ਆ ਠੀਕ ਆ ਔਰ ਜਿਹੜੇ ਅ ਬਨਾਨਾਜ਼ ਨੇ ਉਹ ਮੈਨੂੰ ਉੱਪਰੋਂ ਕਾਲੇ ਵਾਲਾ ਛਿਲਕਾ ਨਹੀਂ ਚਾਹੀਦਾ ਵੀ ਮੈਨੂੰ ਸਾਫ਼ ਚਾਹੀਦੇ ਨੇ ਠੀਕ ਆ ਭਾਅ ਜੀ ਭਾਅ ਜੀ ਤੁਸੀਂ ਹੈ ਨਾ ਮੈਨੂੰ ਹੋਮ ਡਿਲੀਵਰੀ ਕਰ ਸਕਦੇ ਹੋ ਠੀਕ ਹੈ ਅਤੇ ਮੈਂ ਮੈਂ ਤੁਹਾਡੇ ਨਾ ਵਟਸਐਪ 'ਤੇ ਆਪਣਾ ਐਡਰੈਸ ਸੈਂਡ ਕਰ ਦੂੰਗੀ ਅਤੇ ਤੁਸੀਂ ਮੈਨੂੰ ਹੋਮ ਡਿਲੀਵਰੀ ਕਰ ਦਿਓ ਅਤੇ ਮੈਨੂੰ ਦੱਸ ਦਿਉ ਮੈਨੂੰ ਠੀਕ ਹੈ ਮੈਂ ਤੁਹਾਨੂੰ ਗੂਗਲ ਪੇ ਕਰ ਦਾਂਗੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਜੀ